ਹੈਲੋ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਕੀ ਹਾਲ ਚਾਲ ਹੈ ਜੀ ਵੀਰ ਮੈਂ ਤੁਹਾਡੇ ਪੰਜਾਬ ਵਿੱਚ ਘੁੰਮਣ ਆਉਣਾ ਯਾਰ ਮੈਨੂੰ ਤੁਸੀਂ ਇਹ ਦੱਸੋ ਬਈ ਇੱਥੇ ਘੁੰਮਣ ਨੂੰ ਕਿਹੜੀ ਕਿਹੜੀ ਚੀਜ਼ ਵਧੀਆ ਏ ਅਤੇ ਕਿੱਥੇ ਕਿੱਥੇ ਲੈ ਕੇ ਜਾਓਗੇ ਹਾਂਜੀ ਹਾਂਜੀ ਹਾਂਜੀ

ਅਤੇ ਇੱਕ ਮੈਂ ਸੁਣਿਆ ਯਾਰ ਉੱਥੇ ਆਪਣੇ ਅੰਮ੍ਰਿਤਸਰ ਸਾਹਿਬ ਵੀ ਹੈ ਜੀ ਆਪਣੇ ਪੰਜਾਬ ਵਿੱਚ ਪੈਂਦਾ ਕੋਈ ਵਧੀਆ ਉੱਥੇ ਘੁੰਮਣ ਨੂੰ ਹਾਂਜੀ ਹਾਂਜੀ ਉੱਥੇ ਵੀ ਯਾਰ ਦਰਸ਼ਨ ਕਰਵਾ ਦਿਓ ਅਤੇ ਹੋਰ ਕੋਈ ਨੇੜੇ ਤੇੜੇ ਬਾਡਰ ਲੱਗਦਾ ਹੋਵੇ ਉੱਥੇ ਵਾਹਗਾ ਬਾਡਰ ਜਿਵੇਂ ਕਿ ਠੀਕ ਹੈ ਠੀਕ ਹੈ ਅਤੇ ਹੋਰ ਆਪਣਾ ਅਸੀਂ ਵੇਖਦੇ ਹੈ ਯਾਰ ਇਸ ਹਫਤੇ ਹੀ ਆ ਜੂੰਗੇ ਐਂਡ ਜੇ ਵਿੱਚ ਅਤੇ ਮੈਂ ਦੇਖਦਾਂ ਮੇਰੇ ਪਰਿਵਾਰ ਨੇ ਵੀ ਆਉਣਾ ਨਾਲ ਸਾਨੂੰ ਵਧੀਆ ਐਨ ਵਧੀਆ ਉਹ ਚਾਹੀਦਾ ਕੰਮ ਤੁਹਾਡਾ ਕੀ ਕੀ ਫੈਸੇਲਿਟੀ ਹੈ ਤੁਹਾਡੇ ਪਾਸ ਵੀਰ ਹੈਲੋ ਹਾਂਜੀ ਹਾਂਜੀ ਕੂਲਿੰਗ ਕਾਲਿੰਗ ਦੇਖ ਲਿਓ ਯਾਰ ਚੈੱਕ ਕਰ ਲਿਓ ਵਧੀਆ ਹੋਵੇ ਗ ਗਰਮੀ ਬਹੁਤ ਹੈ ਯਾਰ ਉਰੇ ਪੰਜਾਬ ਮ ਗਰਮੀ ਬਹੁਤ ਆ ਕਹਿੰਦੇ ਮੈਂ ਸੁਣਿਆ ਉੱਥੇ ਮੈਨੂੰ ਫੋਨ ਆਇਆ ਸੀ ਭਰਾ ਦਾ ਠੀਕ ਹੈ ਅਤੇ ਪੈਸਾ ਪੁਸੇ ਤੁਹਾਡੇ ਕੀ ਚਾਰਜ ਹੈ ਹਫਤੇ ਦਾ ਕੀ ਹੈ ਅਤੇ ਕਿਲੋਮੀਟਰ ਹੈ ਮੈਨੂੰ ਦੱਸ ਦਉ ਯਾਰ ਸਾਰਾ ਡਿਟੇਲ 'ਚ

ਮਿਲ ਕੇ ਗੱਲ ਕਰ ਲਾਂਗੇ ਹਾਂ ਚਲੋ ਠੀਕ ਹੈ ਸਰ ਓਕੇ ਫਿਰ ਮਿਲਦੇ ਐਂ ਓਕੇ ਥੈਂਕ ਯੂ